ਹੈਲੋ ਜੀ ਤੁਸੀਂ ਟੂ ਟੂਰਿਸਟ ਗਾਈਡ ਬੋਲ ਰਹੇ ਹੋ ਹਾਂਜੀ ਜੀ ਮੈਂ ਪੰਜਾਬ ਨਾ ਪਹਿਲੀ ਵਾਰ ਆਈ ਹਾਂ ਅਤੇ ਮੈਂ ਨਾ ਰੋਪੜ ਰੋਪੜ ਸਿਟੀ ਦੇ ਵਿੱਚ ਆਈ ਹਾਂ ਅਤੇ ਮੈਨੂੰ ਇਹਦਾ ਲੋਕੇਸ਼ਨ ਨਹੀਂ ਪਤਾ ਤੁਸੀਂ ਦੱਸ ਸਕਦੇ ਹੋ ਕਿ ਮੈਂ ਕਿ ਹੋਟਲ ਬੁੱਕ ਕਿੱਥੋਂ ਤੋਂ ਕਰਾਂ ਜਾਂ ਇਹ ਆ ਇ ਇੱਥੇ ਕਿਹੜੀ ਕਿਹੜੀ ਜਗ੍ਹਾ ਏ ਮੈਂ ਘੁੰਮ ਸਕਾਂ ਅਤੇ ਜ਼ਿਆਦਾ ਖਾਣ ਦੀ ਜਗ੍ਹਾਵਾਂ ਇਨ੍ਹਾਂ ਦੇ ਬਾਰੇ ਤੁਸੀਂ ਮੈਨੂੰ ਹਾਂ ਹਾਂਜੀ ਹਾਂਜੀ ਅੱਛਾ ਜੀ ਓਕੇ ਜੀ ਬਸ ਹੋਰ ਤਾਂ ਮੈਨੂੰ ਕੋਈ ਕੁਐਰੀ ਹੋਈ ਤਾਂ ਮੈਂ ਤੁਹਾਨੂੰ ਕੋਲ ਕਰ ਲਵਾਂਗੀ ਥੈਂਕ ਯੂ ਧੰਨਵਾਦ ਜੀ